ਅਸੀਂ ਦੇਖ ਰਹੇ ਹਾਂ ਵੀ ਆਮ ਲੋਕਾਂ ਨੂੰ ਜਿਹੜੇ ਖੇਤੀਬਾੜੀ ਕਿਸਾਨ ਨੇ ਹੋਰ ਉਹਨਾਂ ਨੂੰ ਬੜੀਆਂ ਮਤਲਬ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਜਿਹੜੇ ਖੇਤੀ ਉਤਪਾਦ ਪੈਦਾਵਾਰ ਹੈ ਉਹ ਪਹੁੰਚਾਉਣ ਲਈ ਮੰਡੀ ਵਿੱਚ ਜਾਂ ਕੋਈ ਹੋਰ ਕਈ ਥਾਵਾਂ 'ਤੇ ਜਿਹੜੀ ਹੈ ਮੰਡੀਆਂ ਦੀ ਬੜੀ ਘਾਟ ਹੈ ਪ੍ਰੋਪਰ ਅਤੇ ਜਿਹੜੀਆਂ ਵਸਤਾਂ ਨੇ ਉਹ ਜ਼ਰੂਰੀ ਵਸਤਾਂ ਜਦ ਵੇਚਣ ਲਈ ਜਾਂਦੇ ਆ ਤਾਂ ਉਹਨਾਂ ਨੂੰ ਬੜਾ ਦੂਰ ਪੈ ਜਾਂਦੀ ਆ ਮੰਡੀਆਂ ਇਸ ਲਈ ਜਿਹੜਾ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਮੰਡੀਕਰਨ ਆ ਇਹਦੀਆਂ ਨੀਤੀਆਂ ਨੂੰ ਹੋਰ ਸੌਖਾ ਅਤੇ ਸਰਲ ਕੀਤਾ ਜਾਵੇ ਇਹ ਜਿਹੜੀਆਂ ਮੰਡੀ ਹੈ ਮੰਡੀਕਰਨ ਹੈ ਕਈ ਵਸਤਾਂ ਨੇ ਜਿਵੇਂ ਹੁਣ ਕਣਕ ਜੀਰੀ ਤਾਂ ਮੰਡੀਕਰਨ ਤਾਂ ਹੋ ਜਾਂਦਾ ਕਈ ਵਸਤਾਂ ਜਿਹੜੀਆਂ ਜਿਹਨਾਂ 'ਤੇ ਐੱਮ ਐੱਸ ਪੀ ਵਗੈਰਾ ਮਿਲਦੀ ਨਹੀਂ ਅਤੇ ਕਿਸਾਨ ਪੈਦਾ ਕਰਦੇ ਜਿਵੇਂ ਮੱਕੀ ਵਗੈਰਾ ਉਹ ਕਈ ਥਾਵਾਂ 'ਤੇ ਮਤਲਬ ਕੌਡੀਆਂ ਦੇ ਭਾਅ ਏ ਇਹਨਾਂ ਨੂੰ ਵੇਚਣੀ ਪੈ ਰਹੀ ਹੈ ਅਤੇ ਬੜੀਆਂ ਵੱਡੀਆਂ ਮੁਸ਼ਕਿਲ ਨੇ ਇਸ ਤਰ੍ਹਾਂ ਇਹ ਕਿਸਾਨ ਦੇ ਸਾਹਮਣੇ ਬਾਕੀ ਕਈ ਥਾਵਾਂ 'ਤੇ ਜਿਹੜੇ ਹੈ ਮੰਡੀਕਰਨ 'ਚ ਪ੍ਰਬੰਧ ਵਧੀਆ ਨਹੀਂ ਹੈਗੇ ਦੇਖਿਆ ਅਸੀਂ ਸਿਸਟਮ ਅਤੇ ਉਹ ਮੰਡੀਕਰਨ 'ਚ ਪ੍ਰਬੰਧ ਵਧੀਆ ਨਾ ਹੋਣ ਕਾਰਨ ਕਿਸਾਨਾਂ ਨੂੰ ਉਥੇ ਕੋਈ ਸ਼ਾਨਦਾਰ ਦਰੱਖਤ ਨਹੀਂ ਪਾਣੀ ਨਹੀਂ ਪੀਣ ਨੂੰ ਉਹ ਕਈ ਚੀਜ਼ਾਂ ਦੀ ਘਾਟ ਹੈ ਸੈੱਡਾਂ ਦੀ ਘਾਟ ਹੈ ਇਸ ਤਰ੍ਹਾਂ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਇਸ ਪਾਸੇ ਅਸੀਂ ਚਾਹੁੰਦੇ ਆ ਵੀ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਅਤੇ ਤਾਂ ਜਿਹੜੇ ਖੇਤੀ ਉਤਪਾਦ ਆ ਇਹਨਾਂ ਦੀ ਸਹੀ ਮਾਰਕੀਟਿੰਗ ਹੋ ਸਕੇ